ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ ਹਾਂਜੀ ਅੱਛਾ ਅੱਛਾ ਮਤਲਬ ਡਰੈਸਿੰਗ ਕੋਡ ਹਾਂਜੀ ਸਰ ਦੇਖੋ ਜਿਵੇਂ ਕਿ ਆਮ ਕੁੜੀਆਂ ਗਿੱਧੇ ਵਿੱਚ ਹੈ ਨਾ ਸੂਟ ਸਲਵਾਰ ਹੁੰਦਾ ਜਿਵੇਂ ਹੈ ਨਾ ਉਹਦੇ ਉੱਤੇ ਮਤਲਬ ਪਤਾਸੇ ਵਗੈਰਾ ਜਿਵੇਂ ਲਾਦੀਆਂ ਅਤੇ ਸਿੰਪਲ ਜਿਹਨੂੰ ਇੱਕ ਤਾਂ ਲੇਸ ਹੁੰਦੀ ਆ ਉਹ ਨਹੀਂ ਇੱਕ ਗੋਟਾ ਹੁੰਦਾ ਆਪਣੇ ਪੰਜਾਬੀ ਵਿੱਚ ਹੈ ਨਾ ਉਹ ਵਾਲਾ ਗੋਲਡਨ ਜਾਂ ਸਿਲਵਰ ਕਲਰ ਦਾ ਮਤਲਬ ਸੂਟ 'ਤੇ ਲੱਗਿਆ ਹੋਣਾ ਚਾਹੀਦਾ ਠੀਕ ਆ ਪਤਾਸੇ ਵਗੈਰਾ ਯੂਜ ਕਰਕੇ ਕਿ ਉਹ ਸੂਟ 'ਤੇ ਮਤਲਬ ਕਿ ਡੈਕੋਰੇਸ਼ਨ ਕਰ ਸਕਦੇ ਆ ਅਤੇ ਇੱਕ ਮਤਲਬ ਕਿ ਸੂਟ 'ਤੇ ਇੱਕ ਮਤਲਬ ਹੁੰਦਾ ਘੱਗਰਾ ਘੱਗਰਾ ਵੀ ਪਾ ਸਕਦੇ ਹੈ ਠੀਕ ਹੈ ਜਿਹਦੇ ਵਿੱਚ ਕਿ ਸੂਟ ਪੰਜਾਬੀ ਕੋਟਨ ਦਾ ਹੋਣਾ ਚਾਹੀਦਾ ਸੂਟ ਪਾਉਣਾ ਠੀਕ ਹੈ ਹਾਂਜੀ ਸਰ ਅਤੇ ਜਿਵੇਂ ਜ਼ਰੂਰੀ ਆਪਾਂ ਕਹਿ ਸਕਦੇ ਹਾਂ ਪਰਾਂਦਾ ਹੁੰਦਾ ਹੈ ਨਾ ਪਿੱਪਲ ਪੱਤੀਆਂ ਸੱਗੀ ਫੁੱਲ ਅਤੇ ਮਤਲਬ ਕਿ ਕੈਂਠਾ ਤਵੀਤੀਆਂ ਇਹ ਮਤਲਬ ਜਿਊਲਰੀ ਵਿੱਚ ਆ ਜਾਂਦਾ ਹੈ ਨਾ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਇੱਕ ਹੁੰਦਾ ਕਈ ਵਾਰ ਕਿ ਇੱਕ ਪਿੱਪਲ ਪੱਤੀਆਂ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਹੈ ਨਾ ਕੁੜੀਆਂ ਨੂੰ ਪਿੱਪਲ ਪੱਤੀਆਂ ਨਹੀਂ ਮਿਲਦੀਆਂ ਐਟ ਆ ਟਾਈਮ ਜਾਂ ਕਦੇ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਉਹਦੇ ਲਈ ਕੀ ਇੱਕ ਲੋਟਨ ਹੁੰਦਾ ਲੋਟਨ ਹੈ ਨਾ ਉਹ ਯੂਜ ਕਰ ਸਕਦੇ ਆ ਹਾਂਜੀ ਹਾਂਜੀ ਹਾਂਜੀ ਸਰ ਕੋਈ ਗੱਲ ਨਹੀਂ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ